ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅੱਜ ਦਾ ਜੋ ਯੁੱਗ ਹੈ ਵਾਤਾਵਰਨ ਔਰ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਜਿੱਥੇ ਤੱਕ ਹੋ ਸਕਦੀ ਹੈ ਕਿ ਅਸੀਂ ਆਪਣੀ ਵੱਧ ਤੋਂ ਵੱਧ ਆਪਣੀ ਘਰੇਲੂ ਖੇਤੀ ਪਲੱਸ ਜੋ ਕਿ ਸਾਡੀ ਸਭ ਤੋਂ ਪਹਿਲਾਂ ਖਾਣ ਪਾਣ ਦੇ ਵਿੱਚ ਆਉਣ ਵਾਲੀ ਹੈ ਉਹ ਹੈ ਸਬਜ਼ੀਆਂ ਔਰ ਜੋ ਕਿ ਸਾਡੇ ਹੋਰ ਵੀ ਪੌਦੇ ਹਨ ਜੋ ਕਿ ਸਾਡੇ ਆਮ ਬਾਗ ਬਗੀਚੇ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ ਸਭ ਤੋਂ ਪਹਿਲਾਂ ਜਿਵੇਂ ਕਿ ਅਸੀਂ ਆਪਣੇ ਸਬਜ਼ੀਆਂ ਤੋਂ ਹੀ ਸ਼ੁਰੂ ਕਰਦੇ ਹਾਂ ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਮਿਰਚਾਂ ਮਿਰਚਾਂ ਤੋਂ ਅਸੀਂ ਪਨੀਰੀ ਤਿਆਰ ਕਰ ਸਕਦੇ ਹਾਂ ਪਨੀਰੀ ਤਿਆਰ ਕਰਕੇ ਉਸ ਨੂੰ ਕੁਝ ਸਮੇਂ ਵਾਸਤੇ ਵਧੀਆ ਆਪਣੇ ਹੱਥਾਂ ਦੇ ਨਾਲ ਕਰਕੇ ਬਣਾ ਕੇ ਔਰ ਅੱਖਾਂ ਦੀ ਨਿਗਰਾਨੀ ਦੇ ਸਾਹਮਣੇ ਉਸ ਨੂੰ ਤਿਆਰ ਕਰਕੇ ਸਹੀ ਖਾਦ ਪਾ ਕੇ ਉਸ ਨੂੰ ਅਸੀਂ ਤਿਆਰ ਕਰ ਸਕਦੇ ਹਾਂ ਤਾਂ ਜੋ ਉਸ ਨੂੰ ਅੱਗੇ ਤੋਂ ਅੱਗੇ ਜ਼ਿਆਦਾ ਅਸੀਂ ਵਧਾ ਸਕਦਾ ਹਾਂ ਉਸ ਤੋਂ ਬਾਅਦ ਅਲੱਗ ਅਲੱਗ ਪ੍ਰਕਾਰ ਦੀਆਂ ਵੇਲਾਂ ਹਨ ਜਿਵੇਂ ਮੌਸਮ ਦੇ ਦੇ ਅਸੀਂ ਬੀਜ ਬੀਜ ਕੇ ਅਲੱਗ ਅਲੱਗ ਬੀਜ ਬੀਜੀਏ ਤਾਂ ਜੋ ਉਹਨਾਂ ਦਨ ਨਾਲ ਸਾਨੂੰ ਸਾਡੀਆਂ ਜਿਹੜੀਆਂ ਵੇਲਾਂ ਹੈ ਉਹ ਲੱਗ ਜਾਣਗੀਆਂ ਔਰ ਜਿਸ ਤੋਂ ਸਾਨੂੰ ਤਾਜ਼ੀ ਸਾਫ ਸੁਥਰੀ ਔਰ ਜੋ ਸਬਜ਼ੀ ਹੈ ਸਾਨੂੰ ਮਿਲ ਸਕੇ ਉਹ ਤੋਂ ਬਾਅਦ ਜਿਵੇਂ ਕਿ ਅਸੀਂ ਬਗੀਚੇ ਦੇ ਵਿੱਚ ਆਮ ਫੁਲਵਾੜੀ ਤਿਆਰ ਕਰਦੇ ਹਾਂ ਜਿਵੇਂ ਕਿ ਗੁਲਾਬ ਦਾ ਫੁੱਲ ਹੈ ਗੁਲਾਬ ਦੀ ਫੁੱਲ ਨੂੰ ਅਸੀਂ ਕੱਟ ਕੇ ਕਲਮਾਂ ਤਿਆਰ ਕਰਕੇ ਉਸ ਤੋਂ ਅੱਗੇ ਬੂਟੇ ਤਿਆਰ ਕਰ ਲੈਂਦੇ ਹਨ ਜਿਵੇਂ ਕਿ ਇੱਕ ਨਿੰਬੂ ਹੈ ਔਰ ਕੋਈ ਅੰਬ ਹੈ ਜਾਂ ਕੋਈ ਹੋਰ ਬੂਟਾ ਹੈ ਜਿਸ ਨੂੰ ਅਸੀਂ ਜਿਸਨੂੰ ਆਮ ਭਾਸ਼ਾ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਇਹ ਪਿਉਂਦ ਲੈ ਕੇ ਬਣਾਇਆ ਜਾਂਦਾ ਹੈ ਜਿਵੇਂ ਕਿ ਇੱਕ ਮਸਾਲਾ ਆਉਂਦਾ ਹੈ ਉਸ ਨੂੰ ਇੱਕ ਟਾਹਣੀ ਦੇ ਨਾਲ ਬੰਨ੍ਹ ਕੇ ਤਕਰੀਬਨ ਤਕਰੀਬਨ ਪੰਦਰਾਂ ਤੋਂ ਵੀਹ ਦਿਨ ਜਾਂ ਮਹੀਨੇ ਦਾ ਕੁਛ ਸਮਾਂ ਹੁੰਦਾ ਹੈ ਉਸ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਤਾਂ ਜੋ ਉਸ ਦੇ ਵਿੱਚ ਕੁਛ ਨਵੇਂ ਪੱਤੇ ਉੱਗ ਜਾਂਦੇ ਹਨ ਅਸੀਂ ਉਸ ਨੁੂੰ ਕੱਟ ਕੇ ਦੁਬਾਰਾ ਇੱਕ ਨਵਾਂ ਪੌਦਾ ਤਿਆਰ ਕਰ ਲੈਂਦੇ ਹਾਂ ਔਰ ਉਸ ਨੂੰ ਅਲੱਗ ਜਗ੍ਹਾ ਬਣਾਇਆ ਜਾਂਦਾ ਹੈ ਇੱਕ ਜਗ੍ਹਾ ਹੀ ਪੌਦੇ ਤੋਂ ਕਈ ਪੌਦੇ ਅਸੀਂ ਤਿਆਰ ਕਰ ਸਕਦੇ ਹਨ ਬਾਕੀ ਉਹਨਾਂ ਨੂੰ ਸਹੀ ਸੰਭਾਲਣ ਵਾਸਤੇ ਸਹੀ ਗਰੋਥ ਵਾਸਤੇ ਅਗਰ ਉਸ ਦੀ ਅੱਛੀ ਗਰੋਥ ਹੋਵੇ ਔਰ ਜੋ ਸਬਜ਼ੀ ਹੈ ਚਾਹੇ ਉਹ ਪੌਦਾ ਹੈ ਸਾਨੂੰ ਸਹੀ ਮਿਲੇ ਨੈਚੂਰਲ ਮਿਲੇ ਉਹਦੇ ਵਿੱਚ ਸਾਨੂੰ ਜੋ ਭੈੜੀਆਂ ਦਵਾਈਆਂ ਇਹਨਾਂ ਦਾ ਜ਼ਹਿਰਲੀਆਂ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਵੱਧ ਤੋਂ ਵੱਧ ਜਿੱਥੇ ਤੱਕ ਹੋ ਸਕੇ ਸਹੀ ਬੀਜ ਔਰ ਸਹੀ ਜੋ ਦੇਸੀ ਖਾਦ ਹੈ ਸਾਨੂੰ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਜਿਹਦਾ ਕਿ ਫਸਲ ਦੇ ਔਰ ਜੋ ਫੁਲਵਾੜੀ 'ਤੇ ਮਾੜਾ ਅਸਰ ਨਾ ਪਵੇ